ਸਾਡੇ ਪਿੰਡ ਦਾ ਡਰੇਨੇਜ ਸਿਸਟਮ ਬਹੁਤ ਹੀ ਵਧੀਆ ਹੈ ਜਗ੍ਹਾ ਜਗ੍ਹਾ 'ਤੇ ਨਾਲ਼ੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਉਪਰਾਲੇ ਵੀ ਕੀਤੇ ਜਾਣੇ ਚਾਹੀਦੇ ਹਨ ਡਰੇਨੇਜ ਪਰਨਾਲਿਆਂ ਨੂੰ ਡਿਜ਼ਾਈਨ ਕਰਨ ਅਤੇ ਉਸਾਰਨ ਲਈ ਇੰਜੀਨੀਅਰਾਂ ਦੀ ਮਾਹਰ ਸਲਾਹ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਣੀ ਤੇਜ਼ੀ ਨਾਲ ਅਤੇ ਸੁਚਾਰੂ ਢੰਗ ਨਾਲ ਵਹਿੰਦਾ ਹੈ ਅਤੇ ਇਸ ਦਾ ਨਿਪਟਾਰਾ ਕਿਸੇ ਸਤਿਹ ਵਾਲੇ ਪਾਣੀ ਦੇ ਡੱਬੇ ਜਾਂ ਸਕੋਬੇ ਵਿੱਚ ਕੀਤਾ ਜਾਂਦਾ ਹੈ ਇੱਕ ਕਮਿਊਨਟੀ ਦੁਆਰਾ ਲਗਾਏ ਗਏ ਡਰੇਨੇਜ ਨੂੰ ਦੂਜੇ ਭਾਈਚਾਰਿਆਂ ਲਈ ਡਾਊਨਸਟਰੀਮ ਲਈ ਸਮੱਸਿਆਵਾਂ ਨਹੀਂ ਪੈਦਾ ਕਰਨੀਆਂ ਚਾਹੀਦੀਆਂ ਹਨ ਨਾ ਹੀ ਇਹ ਵਾਤਾਵਰਨ ਤੌਰ 'ਤੇ ਮਹੱਤਵਪੂਰਨ ਸਥਾਨਾਂ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ ਵਾਤਾਵਰਨ ਸੰਬੰਧੀ ਵਿਚਾਰਾਂ 'ਤੇ ਢੁੱਕਵਾਂ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਵਾਤਾਵਰਨ ਵਿੱਚ ਲੰਮੇ ਸਮੇਂ ਦੀਆਂ ਤਬਦੀਲੀਆਂ ਭਵਿੱਖ ਵਿੱਚ ਵਧੇਰੇ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ ਸੰਯੁਕਤ ਨਾਲਿਆਂ ਦਾ ਪ੍ਰਬੰਧ ਵੀ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ ਸੰਯੁਕਤ ਡਰੇਨਾਂ ਨੂੰ ਤੂਫਾਨ ਦੇ ਪਾਣੀ ਅਤੇ ਗੰਧਲੇ ਪਾਣੀ ਨੂੰ ਚੁੱਕਣ ਲਈ ਤਿਆਰ ਕੀਤਾ ਗਿਆ ਹੈ ਜਦੋਂ ਤੱਕ ਇੱਕ ਇੱਕ ਸੰਯੁਕਤ ਡਰੇਨ ਨੂੰ ਚੰਗੀ ਤਰ੍ਹਾਂ ਡਿਜ਼ਾਈਨ ਅਤੇ ਰੱਖ ਰਖਾਅ ਨਹੀਂ ਕੀਤਾ ਜਾਂਦਾ ਹੈ ਹਾਲਾਂਕਿ ਸਲੇਹ ਡਰੇਨ ਦੇ ਅੰਦਰ ਪੁਲ ਹੋ ਜਾਵੇ ਹੋ ਜਾਵੇਗੀ ਅਤੇ ਕੀੜੇ ਦਾ ਪ੍ਰਜਨਣ ਸਥਾਨਾਂ ਦਾ ਨਿਰਮਾਣ ਕਰੇਗੀ ਇਨ੍ਹਾਂ ਸਮੱਸਿਆਵਾਂ ਨੂੰ ਇੱਕ ਛੋਟੇ ਇੰਟਰਸਟ ਡਰੇਨ ਦੇ ਨਾਲ ਇੱਕ ਸਿਸਟਮ ਦੀ ਵਰਤੋਂ ਕਰਕੇ ਦੂਰ ਕੀਤਾ ਜਾ ਸਕਦਾ ਹੈ ਜੋ ਤੂਫਾਨ ਦੇ ਪਾਣੀ ਨੂੰ ਚੁੱਕਣ ਲਈ ਇੱਕ ਵੱਡੇ ਡਰੇਨ ਵਿੱਚ ਸਲੇਜ਼ ਨੂੰ ਲੈ ਜਾਂਦਾ ਹੈ ਜਿਵੇਂ ਕਿ ਸਾਰੇ ਡਰੇਨੇਜ ਪ੍ਰਣਾਲੀਆਂ ਦੇ ਨਾਲ ਇਹ ਜ਼ਰੂਰੀ ਹੈ ਕਿ ਡਰੇਨਾਂ ਨੂੰ ਸਹੀ ਢੰਗ ਨਾਲ ਸੰਚਾਲਤ ਅਤੇ ਰੱਖ ਰਖਾਅ ਕੀਤਾ ਜਾਵੇ ਅਤੇ ਡਰੇਨਾਂ ਤੋਂ ਕੂੜਾ ਸਾਫ ਕੀਤਾ ਜਾਵੇ ਡਰੇਨਾਂ ਨੂੰ ਸੀਵਰੇਜ ਪ੍ਰਣਾਲੀਆਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਅਤੇ ਦੱਬਿਆ ਜਾ ਸਕਦਾ ਹੈ ਇਹ ਸ਼ਹਿਰੀ ਖੇਤਰਾਂ ਲਈ ਵਧੇਰੇ ਢੁੱਕਵਾਂ ਹੈ ਪਰ ਜੇ ਪਿੰਡਾਂ ਦੀਆਂ ਸੜਕਾਂ ਪੱਕੀਆਂ ਹੋਣ ਅਤੇ ਹੜ੍ਹਾਂ ਦਾ ਵਹਾਅ ਮਹੱਤਵਪੂਰਨ ਹੋਵੇ ਤਾਂ ਪੇਂਡੂ ਖੇਤਰਾਂ ਵਿੱਚ ਇਸ ਨੂੰ ਮੰਨਿਆ ਜਾ ਸਕਦਾ ਹੈ ਦੱਬੇ ਹੋਏ ਡਰੇਨਾਂ ਵਿੱਚ ਨਿਯਮਿਤ ਅਤੇ ਇਨਲੈੱਟ ਚੈਂਬਰ ਹੁੰਦੇ ਹਨ ਆਮ ਤੌਰ 'ਤੇ ਸੜਕਾਂ ਦੇ ਕਿਨਾਰੇ ਜੋ ਤੂਫਾਨ ਦੇ ਪਾਣੀ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੰਦੇ ਹਨ